ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਹਾਂਜੀ ਵਧੀਆ ਵਧੀਆ ਤੁਸੀਂ ਦੱਸੋ ਅੱਜ ਤਾਂ ਮੈਂ ਫ੍ਰੀ ਹਾਂ ਬੱਚਿਆਂ ਦੇ ਤਾਂ ਪੇਪਰ ਵੀ ਹੋ ਗਏ ਹੈ ਅਤੇ ਅੱਛਾ ਆਪਣੇ ਇੱਧਰ ਵਾਹਗਾ ਬੋਡਰ ਵੱਲ ਮੈਂ ਵੀ ਸੁਣਿਆ ਸੀ ਕਿ ਵੇਖ ਲਓ ਬਣਾ ਲਓ ਕੋਈ ਜੇ ਬਣਦੀ ਯੋਜਨਾ ਤਾਂ ਚੱਲ ਜਾਂਦੇ ਆਪਾਂ ਚੱਲ ਸਿੰਮੀ ਦੀ ਮੰਮੀ ਨੂੰ ਪੁੱਛ ਲੈਂਦੇ ਹਾਂ ਨਾਲ ਇੱਕ ਦੂਜੀ ਜਾਣੇ ਨੂੰ ਦੂਜੀ ਦੀਦੀ ਜਿਹੜੀ ਉਹਨੂੰ ਪੁੱਛ ਲੈਂਦੇ ਹਾਂ ਹਾਂ ਬਿਲਕੁਲ ਬਿਲਕੁਲ ਮੈਂ ਸੁਣਿਆ ਸੀ ਕਿ ਉਹ ਨਾ ਵਾਹਗਾ ਬਾਡਰ ਤੋਂ ਉਹਨਾਂ ਆਉਣਾ ਵਾ ਅਤੇ ਉਹ ਝੰਡੇ ਦਾ ਸੀਨ ਜਿਹੜਾ ਨਾ ਉਹ ਲੈਣਾ ਉਹਨਾ ਹਾਂ ਹਾਂ ਅਤੇ ਉਹ ਅਸੀਂ ਵੀ ਸ਼ੂਟਿੰਗ ਵੇਖੀ ਸੀ ਉਹ ਵੀ ਬਾਲੀਵੁੱਡ ਦੀ ਹਾਂ ਸਹੀ ਗੱਲ ਹੈ ਸਹੀ ਚੱਲੋ ਫਿਰ ਜੋ ਵੀ ਹੋਣਗੇ ਨਾ ਅੱਗੇ ਮੈਂ ਤੁਹਾਨੂੰ ਫੋਨ ਕਰਕੇ ਨਾ ਦੂਜਿਆਂ ਨਾਲ ਗੱਲ ਕਰਕੇ ਤਾਂ ਫਿਰ ਦੱਸਦੀ ਹਾਂ ਨਹੀਂ ਨਹੀਂ ਨਹੀਂ ਮੈਂ ਪਹਿਲਾਂ ਦੱਸ ਦੂ ਨਹੀਂ ਤੁਸੀਂ ਮੇਕਅਪ ਮੂਕਅਪ ਲੱਗਾ ਲਓ ਆਪਣਾ ਬਾਲੀਵੁੱਡ ਦੀ ਮੂਵੀ ਹੈ ਨਾ ਹਾਂ ਚੱਲੋ ਠੀਕ ਹੈ ਫਿਰ ਮੈਂ ਦੱਸਦੀ ਹਾਂ ਹੈਂ ਹਾਂ ਚੱਲੋ ਠੀਕ ਚੱਲ ਠੀਕ ਹੈ ਸਤਿ ਸ਼੍ਰੀ ਅਕਾਲ